ਭੰਗੜਾ ਪੰਜਾਬੀਆਂ ਦਾ ਪ੍ਰਮੁੱਖ ਲੋਕ ਨਾਚ ਹੈ ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ 'ਤੇ ਕੁੜਤਾ ਅਤੇ ਚਾਦਰਾ ਪਹਿਨਿਆ ਜਾਂਦਾ ਹੈ ਕੰਨਾਂ ਦੇ ਵਿੱਚ ਨੱਤੀਆਂ ਅਤੇ ਪੈਰਾਂ ਦੇ ਵਿੱਚ ਨੋਕ ਵਾਲੀ ਜੁੱਤੀ ਪਾਈ ਜਾਂਦੀ ਹੈ ਪਹਿਲੇ ਸਮਿਆਂ ਵਿੱਚ ਇਹ ਨਾਚ ਗੱਭਰੂਆਂ ਦੁਆਰਾ ਨੱਚਿਆ ਜਾਂਦਾ ਸੀ ਪਰ ਅਜੋਕੇ ਸਮੇਂ ਵਿੱਚ ਇਹ ਪੰਜਾਬ ਦੀਆਂ ਮੁਟਿਆਰਾਂ ਦਾ ਵੀ ਨਾਚ ਬਣ ਚੁੱਕਿਆ ਹੈ ਭੰਗੜਾ ਆਮ ਤੌਰ 'ਤੇ ਹਰ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ ਖਾਸ ਤੌਰ 'ਤੇ ਇਹ ਨਾਚ ਵਿਸਾਖੀ ਦੇ ਮੇਲੇ 'ਤੇ ਨੱਚਿਆ ਜਾਂਦਾ ਹੈ ਭੰਗੜਾ ਪਾਉਣ ਵਾਲਿਆਂ ਦੇ ਹੱਥਾਂ ਦੇ ਵਿੱਚ ਕੜੇ ਅਤੇ ਫਰਲੇ ਵਾਲੀ ਪੱਗ ਉਹਨਾਂ ਨੂੰ ਹੋਰ ਵੀ ਆਕਰਸ਼ਕ ਬਣਾਉਂਦੀ ਹੈ ਭੰਗੜਾ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਵੱਸਦਾ ਹੈ ਭੰਗੜੇ ਦੇ ਪ੍ਰਦਰਸ਼ਨ ਕਰਨ ਵਾਲੇ ਆਪਣੇ ਪਹਿਰਾਵੇ ਦੇ ਥਰੂਅ ਆਪਣੇ ਪੰਜਾਬ ਦੀ ਵਿਰਾਸਤ ਨੂੰ ਦਰਸਾਉਂਦੇ ਹਨ